ਪੰਜਾਬ ਰਾਜ ਬਹੁਤ ਸਾਰੀਆਂ ਨੌਕਰੀਆਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ ਫੀਟਰ ਇਲੈਕਟਸ਼ੀਅਨ ਖਰਾਦੀਆ ਬੈਲਡਰ ਪਾਈਪ ਫੀਟਰ ਪਿੰਟਰ ਪਰ ਇਹ ਸਾਰੀਆਂ ਨੌਕਰੀਆਂ ਪੰਜਾਬ ਵਿੱਚੋਂ ਨਹੀਂ ਮਿਲਦੀਆਂ ਕਿਉਂਕਿ ਪੰਜਾਬ ਦੇ ਲੋਕ ਬਾਹਰ ਜ਼ਿਆਦਾ ਜਾ ਰਹੇ ਨੇ ਅਤੇ ਇਹ ਜਦੋਂ ਵੀ ਕੋਈ ਬਾਹਰ ਦੀ ਯੂਪੀ ਬਿਹਾਰ ਦੇ ਬੰਦੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲ ਰਹੀਆਂ ਹਨ ਅਤੇ ਜ਼ਿਆਦਾਤਰ ਅੱਜ ਕੱਲ ਉਹੀ ਸਾਰੀਆਂ ਫੈਕਟਰੀਆਂ ਵਿੱਚ ਨੌਕਰੀਆਂ ਕਰ ਰਹੇ ਨੇ ਕਿਉਂਕਿ ਪੰਜਾਬ ਵਿੱਚ ਲੋਕ ਲੇਬਰ ਕਰਕੇ ਖੁਸ਼ ਨਹੀਂ ਹਨ